ਸਾਡੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਕਈ ਤਰ੍ਹਾਂ ਦੇ ਪੰਛੀ ਪਾਏ ਜਾਂਦੇ ਹਨ ਜਿਵੇਂ ਕਿ ਕਾਂ ਗਟਾਰਾਂ ਚਿੜੀਆਂ ਤੋਤੇ ਜੋ ਸਾਡੇ ਸ਼ਹੀਦ ਭਗਤ ਸਿੰਘ ਨਗਰ ਵੱਲ ਪਾਏ ਜਾਂਦੇ ਹਨ ਅਤੇ ਸਰਦੀਆਂ ਵਿੱਚ ਜੋ ਪ੍ਰਵਾਸੀ ਪੰਛੀ ਹੈ ਜੋ ਅਪਣੇ ਖਾਣ ਲਈ ਇੰਤਜ਼ਾਮ ਕਰਨ ਲਈ ਬਾਹਰੋਂ ਹਨ ਉਹ ਵੀ ਇੱਧਰ ਦੇਖੇ ਜਾ ਸਕਦੇ ਹਨ ਬਾਕੀ ਜੋ ਆਪਣੇ ਨਿੱਜੀ ਪੰਜਾਬ ਦੇ ਪੰਛੀ ਆ ਜਿਵੇਂ ਕਿ ਗੁਟਾਰਾ ਕਾਂ ਕਬੂਤਰ ਚਿੜੀਆਂ ਜੋ ਇੱਥੇ ਦੇਖੇ ਜਾਂਦੇ ਹਨ ਕਿਉਂਕਿ ਇੱਧਰ ਦਰਿਆਈ ਇਲਾਕਾ ਹੋਣ ਕਰਕੇ ਪੰਛੀਆਂ ਲਈ ਵੀ ਗਰਮੀਆਂ ਵਿੱਚ ਠੰਡਾ ਜੋ ਮੌਸਮ ਉਹਨਾਂ ਨੂੰ ਮਿਲਦਾ ਹੈ